ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗਗਨਪ੍ਰੀਤ ਕੌਰ ਹੈ ਅਤੇ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਜਿਵੇਂ ਕਿ ਸੰਗੀਤ ਆ ਸੰਗੀਤ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਅਤੇ ਸੰਗੀਤ ਦੇ ਨਾਲ ਮੈਨੂੰ ਬਹੁਤ ਜ਼ਿਆਦਾ ਪਿਆਰ ਹੈ ਅਤੇ ਮੈਨੂੰ ਸੰਗੀਤ ਸੁਣਨਾ ਅਤੇ ਸੰਗੀਤ ਵਿੱਚ ਵੀ ਜ਼ਿਆਦਾ ਦਿਲਚਸਪੀ ਹੈ ਅਤੇ ਇਸ ਕਰਕੇ ਮੈਂ ਸੰਗੀਤ ਬਾਰੇ ਕੁਝ ਨੋਲੇਜ ਲੈਣ ਲਈ ਇਹ ਉਹਨਾਂ ਨੂੰ ਸਿੱਖਣਾ ਵੀ ਸ਼ੁਰੂ ਕੀਤਾ ਹੈ ਅਤੇ ਸੰਗੀ ਮੈਂ ਹਰਮੋਨੀਅਮ ਵਜਾਉਣਾ ਉਹ ਵੀ ਸਟਾਰਟ ਕੀਤਾ ਅਤੇ ਹਰਮੋ ਹਾਰਮੋਨੀਅਮ ਵਿੱਚ ਮੈਂ ਸਾ ਰੇ ਗਾ ਮਾ ਪਾ ਤੋਂ ਲੈ ਕੇ ਸ਼ਬਦ ਜਿਹੜੇ ਹੁੰਦੇ ਹਨ ਉਹ ਵੀ ਸਿੱਖੇ ਹਨ ਅਤੇ ਸਾਡੇ ਸਕੂਲ ਵਿੱਚ ਵੀ ਹਰਮੋਨੀਅਮ ਵਗੈਰਾ ਸਿਖਾਇਆ ਜਾਂਦਾ ਹੈ ਅਤੇ ਹਰਮੋਨੀਅਮ ਵਿੱਚ ਮੈਂ ਬਹੁਤ ਜ਼ਿਆਦਾ ਸ਼ਬਦਾਂ ਵਿੱਚੋਂ ਸਿਰ ਘਰ ਬੈਸੋ ਹਰਜਨ ਪਿਆਰੇ ਉਸ 'ਤੇ ਵੀ ਮੈਂ ਸ਼ਬਦ ਹਰਮੋਨੀਅਮ ਉੱਤੇ ਵਜਾਉਣਾ ਸਿੱਖਿਆ ਉਹ ਸ਼ਬਦ ਅਤੇ ਜਿੱਦਾਂ ਵੀ ਮਤਲਬ ਕਿ ਹਰਮੋ ਸਾਡੇ ਸਕੂਲ ਵਿੱਚ ਕੋਈ ਵੀ ਫ ਫੰਕਸ਼ਨ ਵਗੈਰਾ ਹੁੰਦਾ ਸੀ ਅਤੇ ਇੱਕ ਅਨੁਅਲ ਫੰਕਸ਼ਨ ਉਹਦੇ ਵਿੱਚ ਮੈਂ ਹਾਰਮੋਨੀਅਮ ਵਜਾਉਣਾ ਸਿੱਖਿਆ ਸੀ ਅਤੇ ਉਹਦੇ ਸ਼ਬਦ ਮੈਂ ਉੱਥੇ ਉਹ ਫੰਕਸ਼ਨ ਵਿੱਚ ਹਰਮੋਨੀਅਮ 'ਤੇ ਬੋਲਤੇ ਸੀ ਅਤੇ ਮੈਨੂੰ ਫਸਟ ਪ੍ਰਾਈਜ ਮਿਲ ਜਾਂਦਾ ਸੀ ਅਤੇ ਹਰਮੋਨੀਅਮ ਦਾ ਹਰਮੋਨੀਅਮ ਵਿੱਚ ਮੈਂ ਅੱਗੇ ਵੀ ਉਹਨੂੰ ਸਿੱਖਣਾ ਸਿੱਖਣਾ ਹੈ ਅਤੇ ਮੈਂ ਪੂਰੇ ਤਰੀਕੇ ਨਾਲ ਸਿੱਖ ਕੇ ਮੈਂ ਆਪਣੇ ਮੈਂ ਫਰੀ ਟਾਈਮ ਵੀ ਮੈਂ ਸੰਗੀਤ ਵਗੈਰਾ ਵਜਾਉਂਦੀ ਹਾਂ ਘਰ ਪ੍ਰੈਕਟਿਸ ਕਰਦੀ ਹਾਂ ਅਤੇ ਮੈਂ ਇੱਕ ਕਮਰੇ ਵਿੱਚ ਬੈਠ ਕੇ ਅਤੇ ਉਹਦੇ ਵਿੱਚ ਹਰਮੋਨੀਅਮ 'ਤੇ ਆਪਣੇ ਸ਼ਬਦ ਵਗੈਰਾ ਉੱਥੇ ਬੋਲਦੀ ਹਾਂ ਅਤੇ ਹਰਮੋਨੀਅਮ ਮੈਨੂੰ ਮਤਲਬ ਕਿ ਵਜਾਉਣਾ ਬਹੁਤ ਜ਼ਿਆਦਾ ਪਸੰਦ ਹੈ ਅਤੇ ਮੈਂ ਸਕੂਲ ਵਿੱਚ ਵੀ ਇਹਦੀ ਕਲਾਸਿਸ ਲੈਂਦੀ ਹਾਂ ਅਤੇ ਨਾਲ ਬਾਹਰ ਵੀ ਇਹਦੀ ਕਲਾਸਿਸ ਲੈਂਦੀ ਹਾਂ ਅਤੇ ਹਰਮੋਨੀਅਮ ਅੱਗੇ ਮੈਂ ਹਰਮੋਨੀਅਮ ਹੀ ਸਿੱਖਾਂਗੀ